ਭੰਗੜਾ ਮੇਰੇ ਪੰਜਾਬ ਦੇ ਪਿੰਡ ਵਿੱਚ ਸਭ ਤੋਂ ਪ੍ਰਸਿੱਧ ਨਾਚ ਹੈ ਇਹ ਮੇਰੇ ਖੇਤਰ ਵਿੱਚ ਸਭ ਤੋਂ ਪ੍ਰਸਿੱਧ ਅਤੇ ਊਰਜਾਵਾਨ ਨਾਚਾਂ ਵਿੱਚੋਂ ਇੱਕ ਹੈ ਅਤੇ ਲੋਕ ਇਸ ਨੂੰ ਵੱਖ ਵੱਖ ਮੌਕਿਆਂ 'ਤੇ ਪੇਸ਼ ਕਰਨਾ ਪਸੰਦ ਕਰਦੇ ਹਨ ਭੰਗੜਾ ਆਮ ਢੋਲ ਤੌਰ 'ਤੇ ਢੋਲ ਅਤੇ ਇੱਕ ਵੱਡੇ ਢੋਲ ਦੀ ਨਾਚ 'ਤੇ ਤਾਲ 'ਤੇ ਨੱਚਿਆ ਜਾਂਦਾ ਹੈ ਅਤੇ ਇਸ ਦੇ ਨਾਲ਼ ਨਾਲ਼ ਬੋਲੀਆਂ ਵੀ ਗਾਈਆਂ ਜਾਂਦੀਆਂ ਹਨ ਇਹ ਬਹੁਤ ਹੀ ਸਾਰੇ ਮੌਕਿਆਂ ਉੱਤੇ ਨੱਚਿਆ ਜਾਂਦਾ ਹੈ ਜਿਵੇਂ ਕਿ ਵਾਢੀ ਦੇ ਤਿਉਹਾਰ ਭੰਗੜਾ ਅਸਲ ਵਿੱਚ ਕਿਸਾਨਾਂ ਦਾ ਨਾਚ ਹੈ ਜੋ ਕਿ ਕਣਕ ਅਤੇ ਚੌਲਾਂ ਵਰਗੀਆਂ ਫਸਲਾਂ ਦੀ ਵਾਢੀ ਅਤੇ ਜਸ਼ਨ ਮਨਾਉਂਦੇ ਹਨ ਇਹ ਖੁਸ਼ੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਅੱਜ ਵੀ ਲੋਕ ਵਿਸਾਖੀ ਲੋਹੜੀ ਅਤੇ ਪੋਂਗਲ ਵਰਗੇ ਤਿਉਹਾਰਾਂ ਦੌਰਾਨ ਵਾਢੀ ਦੇ ਮੌਸਮ ਦੇ ਅੰਤ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਣ ਲਈ ਭੰਗੜਾ ਨੱਚਦੇ ਹਨ ਇਹ ਉਹਨਾਂ ਦੇ ਉਤਸ਼ਾਹ ਨੂੰ ਜ਼ਾਹਰ ਕਰਨ ਦਾ ਇੱਕ ਤਰੀਕਾ ਹੈ ਲੋਕ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਜਿਵੇਂ ਮਹਿੰਦੀ ਸੰਗੀਤ ਅਤੇ ਹਲਦੀ ਦੇ ਨਾਲ਼ ਨਾਲ਼ ਰਿਸੈਪਸ਼ਨ ਦੌਰਾਨ ਭੰਗੜਾ ਦਾ ਡਾਂਸ ਕਰਦੇ ਹਨ ਭੰਗੜਾ ਵਿਆਹ ਦੇ ਤਿਉਹਾਰਾਂ ਵਿੱਚ ਮਜ਼ੇਦਾਰ ਅਤੇ ਰੌਣਕ ਜੋੜਦਾ ਹੈ ਸੱਭਿਆਚਾਰਿਕ ਸਮਾਗਮਾਂ ਸਥਾਨਕ ਅਤੇ ਰਾਸ਼ਟਰੀ ਪੱਧਰ 'ਤੇ ਵੱਖ ਵੱਖ ਸੱਭਿਆਚਾਰਿਕ ਸਮਾਗਮਾਂ ਅਤੇ ਮੁਕਾਬਲਿਆਂ ਵਿੱਚ ਭੰਗੜਾ ਪੇਸ਼ ਕੀਤਾ ਜਾਂਦਾ ਹੈ ਇਹ ਮੇਰੇ ਖੇਤਰ ਅਤੇ ਇਸ ਲੋਕ ਅਮੀਰ ਵਿਰਾਸਤ ਦੇ ਵਿਭਿੰਨਤਾ ਨੂੰ ਦਰਸਾਉਂਦਾ ਹੈ ਭੰਗੜੇ ਨੂੰ ਅਕਸਰ ਇੱਕ ਸ਼ਾਨਦਾਰ ਪ੍ਰਦਰਸ਼ਨ ਬਣਾਉਣ ਲਈ ਝੂਮਰ ਅਤੇ ਲੁੱਡੀ ਵਰਗੇ ਹੋਰ ਨਾਚਾਂ ਰੂਪ ਨਾਲ਼ ਵੀ ਜੋੜਿਆ ਜਾਂਦਾ ਹੈ ਧੰਨਵਾਦ